ਜੇਕਰ ਅਸੀਂ ਪੰਜਾਬੀ ਗਾਇਕੀ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਗੱਲ ਕਰੀਏ ਤਾਂ ਉਹ ਇੱਕ ਬਹੁਤ ਹੀ ਜ਼ਿਆਦਾ ਵੱਡਾ ਯੋਗਦਾਨ ਕਰਦੇ ਹੈ ਉਹਨਾਂ ਨੇ ਆਪਣੀ ਮਿਹਨਤ ਅਤੇ ਹੁਨਰ ਨਾਲ ਇਸ ਖੇਤਰ ਵਿੱਚ ਇੱਕ ਵੱਖਰਾ ਸਥਾਨ ਬਣਾਇਆ ਹੈ ਅੱਜ ਕੱਲ੍ਹ ਬਹੁਤ ਹੀ ਸਾਰੀਆਂ ਔਰਤਾਂ ਪੰਜਾਬੀ ਗਾਇਕੀ ਵਿੱਚ ਮਸ਼ਹੂਰ ਹੋ ਰਹੀਆਂ ਹਨ ਜਿਹਨਾਂ ਵਿੱਚ ਕੁਛ ਕੁ ਦੇ ਨਾਮ ਹੈ ਨੇਹਾ ਕੱਕੜ ਸੁਨੰਦਾ ਸ਼ਰਮਾ ਅਤੇ ਜੈਸਮੀਨ ਸੈਂਡਲਸ ਮੇਰੀ ਪਸੰਦੀਦਾ ਗਾਇਕ ਸੁਨੰਦਾ ਸ਼ਰਮਾ ਹੈ ਕਿਉਂਕਿ ਮੈਨੂੰ ਉਹਨਾਂ ਦੇ ਗੀਤ ਬਹੁਤ ਹੀ ਅੱਛੇ ਲੱਗਦੇ ਹਨ ਅਤੇ ਮੈਨੂੰ ਉਸ ਦੇ ਗੀਤ ਬਿੱਲੀ ਅੱਖ ਅਤੇ ਜਾਨੀ ਤੇਰਾ ਨਾਂ ਬਹੁਤ ਹੀ ਜ਼ਿਆਦਾ ਪਸੰਦ ਹੈ